ਮੇਰੇ ਅਨੁਸਾਰ ਭੰਗੜਾ ਐਰੋਬਿਕਸ ਨੂੰ ਮਜੇਦਾਰ ਬਣਾਉਣ ਵਿੱਚ ਸੰਗੀਤ ਦਾ ਬਹੁਤ ਹੀ ਵਧੀਆ ਭੂਮਿਕਾ ਵੇ ਕਿਉਂਕਿ ਆਰੋਬਿਕਸ ਜਿਹੜਾ ਹੁੰਦਾ ਉਹਦਾ ਇਹ ਵਾਲਾ ਜਿਹੜਾ ਸੰਗੀਤ ਹੈਗਾ ਵੇ ਬਹੁਤ ਹੀ ਵਧੀਆ ਕੰਮ ਕਰਦਾ ਵੇ ਕਿਉਂਕਿ ਉਂਝ ਬੰਦਾ ਨੱਚਦਾ ਢੋਲ ਨਾਲ ਹੋਰ ਹਿਸਾਬ ਹੁੰਦਾ ਅਤੇ ਜਦੋਂ ਇਹ ਸੰਗੀਤ ਲੱਗਾ ਹੁੰਦਾ ਨਾ ਉਦੋਂ ਅਲੱਗ ਤਰ੍ਹਾਂ ਦਾ ਡਾਂਸ ਹੁੰਦਾ ਔਰ ਇਹ ਬਹੁਤ ਹੀ ਮਜ਼ੇਦਾਰ ਹੁੰਦਾ ਵੇ ਇੱਕ ਤਾਂ ਬੰਦਾ ਨਾਲ ਨਾਲ ਗਾਣਾ ਸੁਣੀ ਜਾਂਦਾ ਸੰਗੀਤ ਸੁਣੀ ਜਾਂਦਾ ਨਾਲ ਉਸ ਹਿਸਾਬ ਨਾਲ ਨੱਚੀ ਜਾਂਦਾ ਇੰਝ ਬੰਦੇ ਦੀ ਨਾ ਬਹੁਤ ਹੀ ਵਧੀਆ ਐਕਸਰਸਾਈਜ਼ ਹੋ ਜਾਂਦੀ ਹੈ ਮੇਰਾ ਬੇਟਾ ਕਰਕੇ ਆਉਂਦਾ ਵੇ ਜਿਮ ਦੇ ਵਿੱਚ ਇਹੋ ਕੁਝ ਕਰਕੇ ਅਤੇ ਫਿਰ ਆ ਕੇ ਮੈਨੂੰ ਦੱਸਦਾ ਵੇ ਮੈਂ ਵੀ ਉਹਦੇ ਐਰੋਬਿਕਸ ਕਰਨੀ ਹਾਂ ਅਤੇ ਮੈਨੂੰ ਉਹਦੇ ਨਾਲ ਮੇਰਾ ਸਰੀਰ ਬੜਾ ਵਧੀਆ ਖੁੱਲਾ ਡੁੱਲਾ ਹੋ ਜਾਂਦਾ ਵੇ ਜਿਵੇਂ ਐਕਸਰਸਾਈਜ਼ ਬਹੁਤ ਵਧੀਆ ਹੋ ਜਾਂਦੀ ਹੈ ਕਿਉਂਕਿ ਐਰੋਬਿਕਸ ਭੰਗੜਾ ਇੱਕ ਤਾਂ ਤੇਜ ਗਾਨਾ ਹੁੰਦੇ ਨੇ ਅਤੇ ਤੇਜ਼ ਨੱਚਿਆ ਜਾਂਦਾ ਵੇ ਮੇਰੇ ਖਿਆਲ 'ਚ ਕੋਈ ਖਾਸ ਸੰਗੀਤ ਦੀ ਵਰਤੋਂ ਇਹਦੇ ਵਿੱਚ ਉਹੀ ਵਾਲੀ ਹੁੰਦੀ ਹੈ ਕਿ ਜਿਹੜੇ ਤੇਜ਼ ਗਾਨਾ ਹੋਵੇ ਅਤੇ ਵਧੀਆ ਨੱਚਿਆ ਜਾਵੇ ਖੁੱਲਾ ਡੁੱਲਾ ਉਹਦੇ ਨਾਲ ਸਾਡਾ ਸਰੀਰ ਵੀ ਚੰਗਾ ਹੁੰਦਾ ਵੇ ਅਤੇ ਸਾਰੀ ਚੰਗੀ ਤਰ੍ਹਾਂ ਐਕਸਰਸਾਈਜ਼ ਵੀ ਹੋ ਜਾਂਦੀ ਹੈ ਅਤੇ ਆਪਣਾ ਸਾਡਾ ਇੰਟਰਟੇਨਮੈਂਟ ਕਿੰਨਾ ਵਧੀਆ ਹੁੰਦਾ ਵੇ ਇਹਦੇ ਨਾਲ ਹੀ ਅਸੀਂ ਬਹੁਤ ਵਧੀਆ ਆਪਣਾ ਸਰੀਰ ਕਰ ਸਕਦੇ ਹਾਂ ਇਹਦੇ ਨਾਲ ਐਰੋਬਿਕਸ ਨਾਲ ਐਰੋਬਿਕਸ ਅਤੇ ਭੰਗੜੇ ਨਾਲ ਧੰਨਵਾਦ ਜੀ